ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਹਾਂਜੀ ਸਰ ਅਸੀਂ ਨਾ ਇੱਥੇ ਬਿਲਕੁਲ ਨਵੇਂ ਆਏ ਹਾਂ ਅਤੇ ਤੁਸੀਂ ਕਾਫ਼ੀ ਟਾਈਮ ਤੋਂ ਰਹਿ ਰਹੇ ਹੋ ਤੁਹਾਨੂੰ ਪਤਾ ਹੋਵੇਗਾ ਕਿ ਫਰੈੱਸ਼ ਵੈਜੀਟੇਬਲ ਕਿੱਥੋਂ ਮਿਲਦੀਆਂ ਠੀਕ ਹੈ ਠੀਕ ਹੈ ਜੀ ਅਸੀਂ ਰੇਲਵੇ ਸਟੇਸ਼ਨ ਦੇ ਨਜ਼ਦੀਕ ਆ ਸਾਨੂੰ ਨੀਅਰ ਬਾਏ ਵੀ ਕਿਹੜਾ ਪਵੇਗਾ ਕੁਛ ਆਈਡੀਆ ਨਹੀਂ ਹੈ ਠੀਕ ਹੈ ਜੀ ਠੀਕ ਹੈ ਅਤੇ ਫਰੈਸ਼ ਮਿਲਦੀਆਂ ਬਿਲਕੁਲ ਸਬਜ਼ੀਆਂ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਅਤੇ ਔਰਗੈਨਿਕਸ ਵੈਜੀਟੇਬਲਸ ਵੀ ਮਿਲ ਜਾਂਦੀਆਂ ਸਰ ਉੱਥੇ ਅਤੇ ਫਰੂਟਸ ਲਈ ਕੋਈ ਅੱਡ ਮਾਰਕੀਟ ਤਾਂ ਨਹੀਂ ਹੈਗਾ ਸੇਮ ਉਹਦੇ 'ਚੋਂ ਹੀ ਮਿਲ ਜਾਣਗੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਾਏ ਓਟੋ ਜਾ ਸਕਦੇ ਹਾਂ ਆਪਾਂ ਹੈ ਨਾ ਠੀਕ ਹੈ ਠੀਕ ਹੈ ਇੱਕ ਵਾਰ ਬਾਏ ਓਟੋ ਚਲੇ ਗਏ ਨਾ ਪਤਾ ਲੱਗ ਜਾਵੇਗਾ ਰਸਤੇ ਦਾ ਕਿਉਂਕਿ ਨਿਊ ਹਾਂ ਬਿਲਕੁਲ ਅਤੇ ਫਿਰ ਤਾਂ ਚਲੋ ਆਪਾਂ ਡੇਲੀ ਬੇਸਿਸ 'ਤੇ ਆਪਾਂ ਵੋਕਿੰਗ ਡਿਸਟੈਂਸ 'ਚ ਮਤਲਬ ਪੈਦਲ ਜਾ ਹੀ ਸਕਦੇ ਹਾਂ ਠੀਕ ਐ ਜੀ ਠੀਕ ਐ ਅਤੇ ਬੈਗਸ ਵਗੈਰਾ ਉਹ ਠੀਕ ਹੈ ਜੀ ਠੀਕ ਹੈ ਠੀਕ ਹੈ ਸਰ ਠੀਕ ਹੈ ਠੀਕ ਹੈ ਅਤੇ ਅਫੋਡੇਬਲ ਪ੍ਰਾਈਜ 'ਚ ਮਿਲ ਜਾਂਦੀ ਹੋਵੇਗੀ ਠੀਕ ਹੈ ਸਰ ਠੀਕ ਹੈ ਠੀਕ ਹੈ ਠੀਕ ਹੈ ਕਾਲ ਚਲੋ ਠੀਕ ਹੈ ਥੈਂਕ ਯੂ ਜੀ ਮੈਂ ਕਾਫ਼ੀ ਪ੍ਰੋਬਲਮ 'ਚ ਸੀਗੀ ਵੀ ਪਤਾ ਨਹੀਂ ਹੈਗਾ ਕੁਛ ਨਿਊ ਹਾਂ ਬਿਲਕੁਲ ਅਤੇ ਥੈਂਕਸ ਤੁਹਾਡਾ ਹਾਂਜੀ ਹਾਂਜੀ ਜ਼ਰੂਰ ਜੀ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਜੀ ਹਾਂਜੀ